ਟ੍ਰੈਡਮਿਲ ਇੱਕ ਇਲੈਕਟ੍ਰਾਨਿਕ ਮਸ਼ੀਨ ਹੈ ਜਿਸ 'ਤੇ ਕਿ ਅੱਜ ਕੱਲ੍ਹ ਦੇ ਬੱਚੇ ਜਿੰਮ ਕਰਨ ਵੇਲੇ ਭੱਜਦੇ ਹਨ ਮੈਂ ਸੋਚਦਾ ਹਾਂ ਕਿ ਇੱਕ ਗਰਾਊਂਡ ਵਿੱਚ ਭੱਜਣਾ ਅਤੇ ਇੱਕ ਟ੍ਰੈਡਮਿਲ ਵਿੱਚ ਭੱਜਣਾ ਬਹੁਤ ਹੀ ਜ਼ਮੀਨ ਅਸਮਾਨ ਦਾ ਫ਼ਰਕ ਹੈ ਅਤੇ ਲੋਕਾਂ ਨੂੰ ਦੌੜਨਾ ਚਾਹੀਦਾ ਹੈ ਜ਼ਮੀਨ 'ਤੇ ਕਿਉਂਕਿ ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਵਾਟ ਕਲੀਅਰ ਕਰ ਲਈ ਹੈ ਅਤੇ ਉੱਥੇ ਜਾ ਕੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਯੋਗਾ ਜਾਂ ਹੋਰ ਐਕਸਰਸਾਇਜਾਂ ਅਸੀਂ ਕਰ ਸਕਦੇ ਹਾਂ ਅਤੇ ਟ੍ਰੈਡਮਿਲ ਉੱਤੇ ਸਿਰਫ਼ ਅਸੀਂ ਰਨਿੰਗ ਕਰ ਸਕਦੇ ਹਾਂ